ਮੇਰੀ ਪਸੰਦੀਦਾ ਖੇਡ ਤੈਰਾਕੀ ਹੈ ਅਤੇ ਮੈਂ ਮੋਸਟਲੀ ਤੈਰਾਕੀ ਸਵੀਮਿੰਗ ਪੂਲ ਦੇ ਵਿੱਚ ਕਰਨਾ ਪਸੰਦ ਕਰਦਾ ਹਾਂ ਜਿੱਦਾਂ ਤੈਰਾਕੀ ਨੂੰ ਅਸੀਂ ਸਮੁੰਦ ਸਮੁੰਦਰ ਦੇ ਕੰਢੇ ਕਰ ਸਕਦੇ ਹਾਂ ਬਟ ਸਮੁੰਦਰ 'ਤੇ ਕਰਨਾ ਥੋੜ੍ਹਾ ਡੇਂਜ਼ਰਸ ਹੁੰਦਾ ਅਤੇ ਇਸ ਲਈ ਮੋਸਟਲੀ ਮੈਂ ਜ਼ਿਆਦਾਤਰ ਸ ਸਵੀਮਿੰਗ ਜਿਹੜੀ ਆ ਆਪਣੀ ਤੈਰਾਕੀ ਹੈਗੀ ਆ ਪੂਲ ਦੇ ਵਿੱਚ ਕਰਨਾ ਪਸੰਦ ਕਰਦਾ ਹਾਂ ਕਪੂਰਥਲੇ ਦੇ ਵਿੱਚ ਦੋ ਤਿੰਨ ਸਕੂਲਜ਼ ਨੇ ਜਿਹੜੇ ਪੂਲ ਚਲਾ ਰਹੇ ਨੇ ਸਭ ਤੋਂ ਵਧੀਆ ਮੈਂਟੇਨ ਜਿਹੜਾ ਪੂਲ ਹੈਗਾ ਆ ਉਹ ਐਮਜਨ ਦਾ ਹੈਗਾ ਹੈ ਜਿਹਦੇ ਵਿੱਚ ਸਵੀਮਿੰਗ ਪੂਲ ਹੈਗਾ ਆ ਅਤੇ ਮੈਂ ਉੱਥੇ ਟਾਈਮ ਆਪਣਾ ਸਵੀਮਿੰਗ ਕਰਨਾ ਪਸੰਦ ਕਰਦਾ ਹਾਂ ਸਵੀਮਿੰਗ ਇੱਕ ਬਹੁਤ ਵਧੀਆ ਖੇਡ ਹੈਗੀ ਆ ਗਰਮੀਆਂ ਦੇ ਵਿੱਚ ਤੁਸੀਂ ਅਗਰ ਜੇ ਸਵੀਮਿੰਗ ਕਰਦੇ ਹੋ ਤੁਹਾਡੀ ਫਿਟਨੈੱਸ ਦੇ ਵਿੱਚ ਬਹੁਤ ਇੰਪਰੂਵਮੈਂਟ ਹੁੰਦੀ ਹੈ ਅਤੇ ਤੁਹਾਡੀ ਗੇਮ ਵੀ ਅੱਛੀ ਰਹਿੰਦੀ ਆ ਟਾਈਮਸ ਬਣਿਆ ਰਹਿੰਦਾ ਆ ਅਤੇ ਫਿਜੀਕਲ ਫਿਟਨੈੱਸ ਸਭ ਤੋਂ ਇੰਪੋਰਟੈਂਟ ਨੇ ਜੋ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਜੋ ਤੈਰਾਕੀ ਇੰਨਾ ਵਧੀਆ ਜਾਂਦੀ ਆ ਅਤੇ ਤੈਰਾਕੀ ਮਾਈਂਡ ਰਿਲੈਕਸ ਕਰਦਾ ਆ ਅਤੇ ਆਪਣੇ ਆਪ ਨੂੰ ਗੇਮ ਦੇ ਵਿੱਚ ਥੋੜ੍ਹਾ ਬਿਜ਼ੀ ਰੱਖਣਾ ਵੀ ਬਹੁਤ ਵਧੀਆ ਆ ਠੀਕ ਆ ਨਾ ਅਤੇ ਸਟੱਡੀ ਦੇ ਨਾਲ ਨਾਲ ਅਗਰ ਜੇ ਤੁਸੀਂ ਸਟੱਡੀ ਜਾਂ ਕੋਈ ਹੋਰ ਕੋਈ ਵੀ ਜੋ ਪ੍ਰੋਫੈਸ਼ਨ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਜੋਬ ਕਰਦੇ ਪਏ ਹੋ ਕੁਛ ਵੀ ਜੋਬ ਕਰਦੇ ਪਏ ਹੋ ਅਗਰ ਤੁਸੀਂ ਆਪਣਾ ਇੱਕ ਪਰਟੀਕੁਲਰ ਟਾਈਮ ਕਿਸੀ ਗੇਮਸ ਨੂੰ ਦੇ ਰਹੇ ਹੋ ਤਾਂ ਬਹੁਤ ਵਧੀਆ ਗੱਲ ਆ ਜਿਹਦੇ ਵਿੱਚ ਤੁਹਾਡਾ ਮਾਈਂਡ ਬਹੁਤ ਰਿਲੈਕਸ ਹੁੰਦਾ ਹੈ ਸਟ੍ਰੈੱਸ ਫ੍ਰੀ ਹੁੰਦਾ ਆ ਅਤੇ ਉਹ ਸਭ ਤੋਂ ਵਧੀਆ ਮੈਨੂੰ ਗੇਮ ਉਹਦੇ ਵਿੱਚ ਸਵੀਮਿੰਗ ਲੱਗਦੀ ਹੈ ਅਤੇ ਮੇਰੇ ਹਿਸਾਬ ਨਾਲ ਤਾਂ ਸਾਰਿਆਂ ਨੂੰ ਸਵੀਮਿੰਗ ਆਉਣੀ ਚਾਹੀਦੀ ਹੈ ਇੱਕ ਲਾਈਫ਼ ਸੇਵਿੰਗ ਗੇਮ ਹੈਗੀ ਆ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੀ ਬਚਾਉਂਦੇ ਹੋ ਅਗਰ ਇਨ ਕੇਸ ਕੋਈ ਡੁੱਬਦਾ ਆ ਜਾਂ ਤੁਸੀਂ ਤੁਹਾਨੂੰ ਸਵੀਮਿੰਗ ਆਉਂਦੀ ਹੈ ਤੁਸੀਂ ਉਹਦੀ ਵੀ ਹੈਲਪ ਕਰਦੇ ਹੋ ਅਤੇ ਸਵੀਮਿੰਗ ਦਾ ਬੈਸਟ ਗੇਮ ਜੋ ਮੈਨੂੰ ਲੱਗਦਾ ਆ ਜੋ ਮੇਰੇ ਅਕੋਰਡਿੰਗ ਬਹੁਤ ਅੱਛੀ ਹੋਬੀ ਅਤੇ ਬਹੁਤ ਅੱਛੀ ਐਕਟੀਵਿਟੀ ਆ